ਅਸੀਂ ਆਪਣੇ ਘਰ ਵਿੱਚ ਆਪਦਾ ਵੀ ਰੁਜ਼ਗਾਰ ਕਰ ਸਕਦੇ ਹਾਂ ਜਿਵੇਂ ਕਿ ਸਿਲਾਈ ਸਿਲਾਈ ਇੱਕ ਮਹੱਤਵਪੂਰਨ ਉਦਯੋਗ ਹੈ ਜੋ ਕਿ ਲੈ ਲੇਡੀਜ ਲਈ ਹੈਗਾ ਇਸ ਨਾਲ ਸਾਨੂੰ ਬਹੁਤ ਵਧੀਆ ਬੈਨੀਫਿਟ ਵੀ ਹੁੰਦਾ ਹੈ ਇਹ ਸਾਡਾ ਰੁਜ਼ਗਾਰ ਵੀ ਹੈ ਸਾਡੇ ਰੁਜ਼ਗਾਰ ਨੂੰ ਵੀ ਵਧੀਆ ਬਡੋਤਰੀ ਦਾ ਕੰਮ ਕਰਦਾ ਇਸ ਵਿੱਚ ਅਸੀਂ ਜਿਵੇਂ ਪੈਂਟ ਪਲਾਜੋ ਹੋ ਗਏ ਸ਼ਰਾਰਾ ਹੋ ਗਿਆ ਕੱਟ ਵਰਕ ਹੋ ਗਏ ਕੁੜਤੀਆਂ ਹੋ ਗਈਆਂ ਲੋਂਗ ਸਕਰਟਾਂ ਵਗੈਰਾ ਹੋ ਗਈਆਂ ਫਰੋਕ ਵਗੈਰਾ ਹੋ ਗਈਆਂ ਸਿੰਪਲ ਸੂਟ ਹੋ ਗਿਆ ਡਿਜ਼ਾਇਨਿੰਗ ਸੂਟ ਹੋ ਗਿਆ ਇੱਦਾਂ ਦੇ ਅਸੀਂ ਬਹੁਤ ਸਿਲਾਈ ਕਰ ਸਕਦੇ ਇਸ ਨਾ ਸਾਨੂੰ ਇਹ ਵਧੀਆ ਸੱਭਿਆਚਾਰ ਤੌਰ 'ਤੇ ਅਸੀਂ ਕੁਛ ਕੁ ਸੱਭਿਆਚਾਰ ਡਰੈਸਾਂ ਵੀ ਸੀ ਸਕਦੇ ਆ ਜਿਵੇਂ ਲਹਿੰਗਾ ਹੋ ਗਿਆ ਲੋਂਗ ਕਮੀਜ਼ ਹੋ ਗਿਆ ਸਲਵਾਰ ਹੋ ਗਈ ਸਾਡੇ ਸੱਭਿਆਚਾਰ ਨੂੰ ਵੀ ਵਧੀਆ ਪ੍ਰੇਰਿਤ ਕਰਦੇ ਹੈ ਸਾਡਾ ਸੱਭਿਆਚਾਰ ਨਾਲ ਜੋੜਨ 'ਚ ਸਹਿਯੋਗ ਮਿਲਦਾ ਅਤੇ ਅੱਜ ਕੱਲ੍ਹ ਦੇ ਸਮੇਂ ਵਿੱਚ ਅਸੀਂ ਆਪਣੇ ਸੱਭਿਆਚਾਰ ਨੂੰ ਵੀ ਕਾਮਯਾਬ ਕਰਦੇ ਹਾਂ ਇਸ ਨਾਲ ਸਾਡਾ ਸੱਭਿਆਚਾਰ ਵੀ ਵਧੀਆ ਰਹਿੰਦਾ ਹੈ ਅਤੇ ਸਰਵਾਈ ਜੋ ਕਿ ਸਾਡੇ ਲੇਡੀਜ ਲਈ ਬਹੁਤ ਵਧੀਆ ਬੈਨੀਫਿਟ ਹੁੰਦਾ ਹੈ